ਡਾਂਸ ਸਾਡੇ ਪਿੰਡਰ ਭਾਰਤ ਦੀ ਸੰਸਕ੍ਰਿਤੀ ਅਤੇ ਪਰੰਪਰਾ ਦਾ ਇੱਕ ਮਹੱਤਵਪੂਰਨ ਹਿੱਸਾ ਹੈ ਇਹ ਭਾਵਨਾਵਾਂ ਕਹਾਣੀਆਂ ਵਿਸ਼ਵਾਸਾਂ ਅਤੇ ਕਦਰਾਂ ਕੀਮਤਾਂ ਨੂੰ ਪ੍ਰਗਟ ਕਰਨ ਦਾ ਇੱਕ ਬਹੁਤ ਹੀ ਵਧੀਆ ਤਰੀਕਾ ਹੈ ਡਾਂਸ ਵਿੱਚ ਮਨੋਰੰਜਨ ਅਤੇ ਸਮਾਜਿਕ ਮੇਲ ਜੋਲ ਦਾ ਇੱਕ ਇਹੋ ਜਿਹਾ ਰੂਪ ਹੈ ਕਿ ਲੋਕ ਵੱਖ ਵੱਖ ਕਾਰਨਾਂ ਕਰਕੇ ਨੱਚਣ ਦਾ ਆਨੰਦ ਲੈਂਦੇ ਹਨ ਜਿਵੇਂ ਕਿ ਤਿਉਹਾਰ ਮਨਾਉਣਾ ਰਸਮਾਂ ਨਿਭਾਉਣੀਆਂ ਪ੍ਰਤੀਭਾ ਦਾ ਪ੍ਰਦਰਸ਼ਨ ਕਰਨਾ ਜਾਂ ਸਿਰਫ਼ ਮਸਤੀ ਕਰਨਾ ਭਾਰਤ ਵਿੱਚ ਡਾਂਸ ਕਈ ਕਿਸਮਾਂ ਦਾ ਹੈ ਹਰ ਇੱਕ ਦੀ ਆਪਣੀ ਸ਼ੈਲੀ ਸੰਗੀਤ ਪਹਿਰਾਵੇ ਅਤੇ ਹਰਕਤਾਂ ਹਨ ਭਰਤਨਾਟਿਅਮ ਕੱਥਕ ਕੱਥਕ ਕਲੀ ਕੁਚੀਪੁੜੀ ਮਣੀਪੁਰੀ ਓਡੀਸੀ ਅਤੇ ਸਤਰੀਆ ਹਨ ਇਹ ਕਲਾਸੀਕਲ ਨਾਚ ਹਨ ਜਿਨ੍ਹਾਂ ਦਾ ਲੰਮਾ ਇਤਿਹਾਸ ਹੈ ਅਤੇ ਸਰਕਾਰ ਦੁਆਰਾ ਰਾਸ਼ਟਰੀ ਖਜ਼ਾਨੇ ਵਿੱਚੋਂ ਮਾਨਤਾ ਵੀ ਪ੍ਰਾਪਤ ਹੈ ਇੱਥੇ ਲੋਕ ਨਾਚ ਵੀ ਹਨ ਜੋ ਕਿ ਖੇਤਰੀ ਸੱਭਿਆਚਾਰਾਂ ਅਤੇ ਵਿਮ ਵਿਭਿੰਨਤਾ ਨੂੰ ਅਤੇ ਅਮੀਰੀ ਨੂੰ ਦਰਸਾਉਂਦੇ ਹਨ ਜਿਵੇਂ ਕਿ ਭੰਗੜਾ ਪੰਜਾਬ ਵਿੱਚ ਗਰਬਾ ਗੁਜਰਾਤ ਵਿੱਚ ਕੁਮਾਰ ਲਾਵਣੀ ਅਤੇ ਰਾਸ ਇਹ ਆਮ ਤੌਰ 'ਤੇ ਤਿਉਹਾਰਾਂ ਜਾਂ ਵਿਸ਼ੇਸ਼ ਮੌਕਿਆਂ ਦੌਰਾਨ ਕੀਤੇ ਜਾਂਦੇ ਹਨ ਇਸ ਤੋਂ ਇਲਾਵਾ ਆਧੁਨਿਕ ਨਾਚ ਵੀ ਹਨ ਜੋ ਪੱਛਮੀ ਸਟਾਈਲ ਤੋਂ ਪ੍ਰਭਾਵਿਤ ਹਨ ਜਿਵੇਂ ਕਿ ਬਾਲੀਵੁੱਡ ਹਿਪਹੋਫ ਜੈਜ ਸਾਲਸਾ ਇਹ ਨੌਜਵਾਨ ਪੀੜ੍ਹੀ ਵਿੱਚ ਬਹੁਤ ਹੀ ਜ਼ਿਆਦਾ ਪ੍ਰਸਿੱਧ ਹਨ ਅਤੇ ਅਕਸਰ ਫ਼ਿਲਮਾਂ ਅਤੇ ਟੀ ਵੀ ਸ਼ੋਅ ਦੇ ਮੁਕਾਬਲੇ ਵੀ ਵਿੱਚ ਦੇਖੇ ਜਾ ਸਕਦੇ ਹਨ ਧੰਨਵਾਦ